ਸੋਸ਼ਲ ਮੀਡੀਆ ਪਲੇਟਫੋਮਾਂ ਨੇ ਲੋਕਾਂ ਨੂੰ ਬਹੁਤ ਹੀ ਅੱਗੇ ਪਹੁੰਚਾਇਆ ਅੱਜ ਕੱਲ੍ਹ ਅਸੀਂ ਕਈ ਸ਼ਿਲਪਕਾਰੀ ਕਲਾ ਵਗੈਰਾ ਦੇਖਦੇ ਹਾਂ ਜੇ ਅਸੀਂ ਸਿੱਖਣਾ ਚਾਹੀਏ ਬੜੇ ਆਰਾਮ ਨਾਲ ਗੂਗਲ ਤੋਂ ਯੂਟੀਊਬ ਤੋਂ ਕਿੰਨੀਆਂ ਇੱਦਾਂ ਜਿਹੇ ਪਲੇਟਫੋਮ ਹੈਗੇ ਹੈ ਜਿਸ 'ਚੋਂ ਅਸੀਂ ਆਰਾਮ ਨਾਲ ਸਿੱਖ ਸਕਦੇ ਹਾਂ ਕਈ ਸ਼ਿਲਪਕਾਰਾਂ ਤੋਂ ਅਸੀਂ ਕਈ ਕਈ ਚੀਜ਼ਾਂ ਇੱਦਾਂ ਦੀਆਂ ਸਿੱਖਦੇ ਹਾਂ ਕਿ ਜਿਹਦੇ ਨਾਲ ਸਾਨੂੰ ਬੜੀ ਹੈਲਪ ਹੁੰਦੀ ਹੈ ਅਤੇ ਅਸੀਂ ਆਪਣੇ ਆਪ ਵੀ ਉਹ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਤਸ਼ਾਹ ਮਿਲਦਾ ਹੈ ਇੱਦਾਂ ਦੀਆਂ ਚੀਜ਼ਾਂ ਦੇਖਣ 'ਚ ਕਿ ਹਾਂ ਜੇ ਅਗਰ ਉਹ ਕਰ ਸਕਦੇ ਹੈ ਤਾਂ ਅਸੀਂ ਵੀ ਉਹਨਾਂ ਵਰਗਾ ਕਰ ਸਕਦੇ ਹਾਂ ਅਗਰ ਸਾਨੂੰ ਸਹੀ ਰਾਹ ਦਿਖੇ ਅਤੇ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਨੇ ਇੱਕ ਪਾਸੇ ਇਹ ਵੀ ਬੜੀ ਅੱਛੀ ਚੀਜ਼ ਕੱਢੀ ਹੈ ਕਿ ਜਿਹੜੇ ਚੀਜ਼ ਕੋਈ ਸਿੱਖਣਾ ਚਾਹੁੰਦਾ ਹੈ ਉਹ ਘਰ ਬੈਠੇ ਬੜੇ ਆਰਾਮ ਨਾਲ ਸਿੱਖ ਸਕਦਾ ਹੈ